ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਰਮਨ ਮੀਟ ਸ਼ੌਪ ਤੋਂ ਬੋਲਦੇ ਜੀ ਠੀਕ ਆ ਬਾਈ ਜੀ ਮੈਂ ਸਨੋਰ ਤੋਂ ਬੋਲ ਰਿਹਾ ਜੀ ਪ੍ਰਭਜੋਤ ਸਿੰਘ ਅਤੇ ਨਾ ਆਉਂਦੇ ਐਤਵਾਰ ਦਾ ਜੀ ਆਪਣਾ ਚੌਦ੍ਹਾਂ ਤਰੀਕ ਦਾ ਆਪਣਾ ਪ੍ਰੋਗਰਾਮ ਹੈ ਜੀ ਦੋ ਸੌ ਬੰਦੇ ਦਾ ਪ੍ਰੋਗਰਾਮ ਹੈ ਜੀ ਉਹਦੇ ਵਿੱਚ ਆਪਾਂ ਨੂੰ ਬੱਕਰਾ ਅਤੇ ਮੁਰਗਾ ਚਾਹੀਦਾ ਜੀ ਹਾਂਜੀ ਹਾਂ ਅਤੇ ਰੇਟ ਰੂਟ ਕੀ ਹੈ ਜੀ ਆਪਣਾ ਅੱਛਾ ਅੱਛਾ ਠੀਕ ਹੈ ਜੀ

ਹਮ ਨਹੀਂ ਪੀਸ ਤਾਂ ਆਪਾਂ ਨੂੰ ਲਿਆਰਾ ਹੀ ਚਾਹੀਦਾ ਜੀ ਪਰ ਤੁਸੀਂ ਸਾਨੂੰ ਬੇਨਤੀ ਹੈ ਤੁਹਾਨੂੰ ਵੀ ਮੈਨੂੰ ਮੇਰੇ ਦੋਸਤ ਹੈ ਇੱਕ ਇੱਥੇ ਧਰਮਿੰਦਰ ਸਿੰਘ ਉਹਨੇ ਤੁਹਾਡਾ ਰੈਫਰੈਂਸ ਦਿੱਤਾ ਸੀਗਾ ਵੀ ਤੁਸੀਂ ਸਾਨੂੰ ਛੇ ਸੌ ਰੁਪਏ ਲਿਆਰਾ ਹੀ ਲਾਓ ਲਿਆਰਾ ਹੀ ਲੈਣਾ ਬੱਕਰਾ ਤਾਂ ਆਪਾਂ

ਦੋ ਸੌ ਬੰਦੇ ਦਾ ਪ੍ਰੋਗਰਾਮ ਹੈ ਜੀ ਅਤੇ ਮੁਰਗਾ ਵੀ ਮੁਰਗਾ ਵੀ ਚਾਹੀਦਾ ਜੀ ਹਾਂ ਹਾਂਜੀ ਹਾਂ ਹਾਂਜੀ ਹਾਂ ਬਸ ਠੀਕ ਹੈ ਮੁਰਗੇ ਦੇ ਵਿੱਚ ਵੀ ਹਾਂਜੀ ਹਾਂ ਸਰ ਦੋ ਸੌ ਬੰਦੇ ਦੇ ਪ੍ਰੋਗਰਾਮ 'ਚ ਪੰਜਾਹ ਸੱਠ ਕੁ ਬੰਦੇ ਹੋਣਗੇ ਖਾਣ ਵਾਲੇ ਲਗਭਗ ਅਤੇ ਮੁਰਗੇ ਦੇ ਵਿੱਚ ਵੀ ਤੁਸੀਂ ਹਾਂ ਚੈਸਟ ਅਤੇ ਲੈਗ ਦੋਵੇਂ ਚਾਹੀਦੀਆਂ ਆਪਾਂ ਨੂੰ ਰੋਸਟਡ ਦੇ ਵਿੱਚ ਕਿਉਂਕਿ ਤੰਦੂਰੀ ਦੇ ਵਿੱਚ ਲੈਗ ਹਾਂ ਬਰਾਬਰ ਕਰ ਦਿਓ ਜੀ ਹਾਂ ਹਮ ਹਾਂਜੀ ਸਨੋਰ ਜੀ ਸਨੋਰ ਨਹੀਂ ਪਹੁੰਚ ਪਹੁੰਚ ਤੁਸੀਂ ਕਰ ਦਿਓ ਜੀ ਤੁਹਾਡੇ ਫਿਰ ਸਾਧਨ ਹੁੰਦੇ ਨੇ ਉੱਦਾਂ ਦੇ ਹਾਂਜੀ ਹਾਂ ਠੀਕ ਹੈ ਅਤੇ ਅਡਵਾਂਸ ਕੋਈ ਤੁਹਾਨੂੰ ਦਈਏ ਕਿ ਕਿਵੇਂ ਬਾਅਦ 'ਚ ਕਰਨਾ ਹਿਸਾਬ ਆਪਾਂ ਹਾਂਜੀ ਹਾਂ ਚੌਦ੍ਹਾਂ ਜਨਵਰੀ ਹੈ ਜੀ ਠੀਕ ਹੈ ਦਿਨ ਦਾ ਪ੍ਰੋਗਰਾਮ ਜੀ ਆਪਣਾ ਠੀਕ ਹੈ ਜੀ ਚੰਗਾ ਜੀ ਧੰਨਵਾਦ ਜੀ